ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਮਨਰਾਜ ਦੀ ਮਦਰ ਬੋਲ ਰਹੀ ਹਾਂ ਅਤੇ ਮੈਂ ਉਹ ਦਾ ਫਸਟ ਯੂਨਿਟ ਦਾ ਜਿਹੜਾ ਰਿਜਲਟ ਆ ਉਹ ਪਤਾ ਕਰਵਾਉਣ ਲਈ ਤੁਹਾਨੂੰ ਫੋਨ ਕੀਤਾ ਸੀ ਅਤੇ ਜੀ ਜੀ ਓਕੇ ਓਕੇ ਓਕੇ ਓਕੇ ਅਤੇ ਪੰਜਾਬੀ ਵਿੱਚ ਤਾਂ ਠੀਕ ਆ ਮੈਮ ਹੈ ਨਾ ਅੱਛਾ ਅੱਛਾ ਠੀਕ ਠੀਕ ਓਕੇ ਓਕੇ ਅਤੇ ਮੈਮ ਗੇਮਸ ਦੇ ਵਿੱਚ ਕਿਵੇਂ ਆ ਪਰਫੋਰਮ ਕਰ ਰਿਹਾ

ਹਾਂਜੀ ਹਮ ਓਕੇ ਓਕੇ ਓਕੇ ਨਹੀਂ ਓਵਰਆਲ ਮੈਮ ਪਰਫੋਰਮੈਂਸ ਠੀਕ ਹੈ ਨਾ ਸਾਰੇ ਸਬਜੈਕਟਸ 'ਚ ਅਗਰ ਆਪਾਂ ਕਹੀਏ ਹਾਂ ਓਕੇ ਓ ਓਕੇ ਓਕੇ ਚਲੋ ਠੀਕ ਹੈ ਮੈਮ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ